ਕੋਈ ਵੀ ਲੇਖਕ ਅਗਰ ਕੁਝ ਵੀ ਲਿਖਦਾ ਹੈ ਤਾਂ ਉਹ ਹਮੇਸ਼ਾਂ ਉਹੀ ਲਿਖਦਾ ਜੋ ਉਸਨੂੰ ਅਹਿਸਾਸ ਹੁੰਦਾ ਹੈ ਅਤੇ ਜੇਕਰ ਮੈਂ ਵੀ ਕਦੇ ਆਪਣੀ ਜ਼ਿੰਦਗੀ ਵਿੱਚ ਜੋ ਕੁਝ ਵੀ ਲਿਖਿਆ ਹੈ ਮੈਂ ਹਮੇਸ਼ਾਂ ਉਹੀ ਲਿਖਿਆ ਜੋ ਮੇਰੇ ਦਿਲ ਨੇ ਚਾਹਿਆ ਹੋਵੇ ਜਾਂ ਮੈਂ ਕਦੇ ਫੀਲ ਕੀਤਾ ਹੋਵੇ ਜਾਂ ਫਿਰ ਮੈਨੂੰ ਫੀਲ ਆ ਰਿਹਾ ਹੋਵੇ ਅਤੇ ਮੈਨੂੰ ਨਹੀਂ ਲੱਗਦਾ ਹੈ ਕਿ ਮੇਰੀਆਂ ਲੇਖਕ ਲਿਖਤਾਂ ਦੇ ਵਿੱਚ ਕੁਝ ਬਾਕੀ ਲੇਖਕਾਂ ਨਾਲੋਂ ਵੱਖਰਾ ਹੈ ਬਾਕੀ ਲੇਖਕ ਆਪਣੇ ਮੁਤਾਬਿਕ ਮੁੱਦੇ ਟੋਪਿਕ ਲੈਂਦੇ ਨੇ ਅਤੇ ਮੇਰੇ ਮੁਤਾਬਿਕ ਟੋਪਿਕ ਹੋਰ ਹੁੰਦੇ ਨੇ ਜਿਹਨਾਂ ਦੇ ਉੱਤੇ ਮੇਰੀਆਂ ਸੋਚਾਂ ਆਪਣੀ ਆਪਣੀ ਪਰਸੈਪਸ਼ਨ ਦੇ ਅਕੋਡਿੰਗ ਹੋਰ ਹੁੰਦੀ ਆ ਮੈਨੂੰ ਜ਼ਿਆਦਾਤਰ ਸ਼ੌਂਕ ਆ ਵੀ ਮੈਂ ਜਿਹੜੇ ਸ਼ਬਦ ਆ ਲਿਖਤਾਂ ਦੇ ਵਿੱਚ ਸ਼ਬਦ ਆ ਜਿਹੜੇ ਉਹ ਪੰਜਾਬੀ ਜਾਂ ਉਰਦੂ ਭਾਸ਼ਾ ਦੇ ਲਵਾਂ ਜਿੱਦਾਂ ਕਿ ਮੈਨੂੰ ਸ਼ਾਇਰੀਸ ਵਗੈਰਾ ਜਾਂ ਫਿਰ ਬਹੁਤ ਹੀ ਜ਼ਿਆਦਾ ਲੇਖ ਵਗੈਰਾ ਲਿਖਣ ਦਾ ਸ਼ੌਂਕ ਹੈ ਤਾਂ ਫਿਰ ਮੈਨੂੰ ਉਸ ਵਿੱਚ ਹੁੰਦਾ ਹੈ ਵੀ ਮੈਨੂੰ ਆਪਣੀ ਸੋਚ ਅਤੇ ਮੁਤਾਬਿਕ ਤਰ੍ਹਾਂ ਲੈ ਕੇ ਜਾਵਾਂ ਅਤੇ ਉਹਨਾਂ ਨੂੰ ਆਪਣੇ ਅਹਿਸਾਸ ਪਾਵਾਂ ਪਰੰਤੂ ਮੇਰੀ ਲਿਖਤਾਂ ਦੇ ਵਿੱਚ ਬਹੁਤ ਕੁਝ ਅਜਿਹਾ ਵੀ ਹੈ ਜਿਸ ਵਿੱਚ ਮੈਨੂੰ ਬਹੁਤ ਕੁਛ ਸੁਧਾਰਨ ਚਾਹੀਦਾ ਹੈ ਕਈ ਵਾਰ ਮੇਰੇ ਦਿਲ ਵਿੱਚ ਜੋ ਕੁਝ ਆ ਰਿਹਾ ਹੁੰਦਾ ਹੈ ਉਹ ਮੇਰੇ ਤੋਂ ਸਹੀ ਪ੍ਰਕਾਰ ਨਹੀਂ ਬਣ ਪਾਉਂਦਾ ਅਤੇ ਕਈ ਵਾਰ ਕੁਝ ਅਜਿਹਾ ਹੋ ਜਾਂਦਾ ਹੈ ਕਿ ਜੋ ਮੈਂ ਉਸ ਵਿੱਚ ਸੋਚਣਾ ਚਾ ਚਾਹ ਰਹੀ ਹਾਂ ਉਹ ਦੂਜੇ ਨਹੀਂ ਸੋਚ ਪਾਉਂਦੇ ਜੇ ਉਹਨਾਂ ਨੂੰ ਉੱਦਾਂ ਦਾ ਮਤਲਬ ਨਹੀਂ ਨਿਕਲਦਾ ਇਸ ਕਰਕੇ ਮੈਂ ਇਹ ਚੀਜ਼ ਸੁਧਾਰਨਾ ਚਾਹੁੰਦੀ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਮੈਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਮੇਰੇ ਮੈਂ ਬਹੁਤ ਹੀ ਪ੍ਰਕਾਰ ਦੇ ਮਾਧਿਅਮ ਲਾਈਕ ਗੂਗਲ ਯੂਟਿਊਬ ਐਂਡ ਡਿਫਰੈਂਟ ਟਾਈਪ ਔਫ ਵੇਅ ਨੇ ਜਿਹੜੇ ਉੱਥੋਂ ਬਹੁਤ ਹੀ ਸਾਰੇ ਸ਼ਬਦਾਂ ਦੇ ਮਤਲਬ ਸਿੱਖੇ ਹਨ ਅਤੇ ਉਹਨਾਂ ਦੀ ਕੋਸ਼ਿਸ਼ ਕਰਨੀ ਹੈ ਕਿ ਉਹਨਾਂ ਸ਼ਬਦਾਂ ਨੂੰ ਮੈਂ ਆਪਣੀ ਲਿਖਤਾਂ ਦੇ ਵਿੱਚ ਪਾ ਸਕਾਂ ਅਤੇ ਲਿਖਤਾਂ ਵਿੱਚ ਪਾ ਕੇ ਮੈਂ ਜਿਸ ਨੂੰ ਵੀ ਉਹ ਸੁਣਾਵਾਂ ਅਤੇ ਉਹ ਮੇਰੇ ਅਹਿਸਾਸ ਅਤੇ ਫੀਲ ਨੂੰ ਸਮਝ ਸਕੇ ਜਿੱਦਾਂ ਕਿ ਜੋ ਮੈਂ ਉਸ ਬਾਰੇ ਜੋ ਉਸ ਚੀਜ਼ ਬਾਰੇ ਲਿਖਿਆ ਹੈ ਉਹ ਉਸ ਚੀਜ਼ ਬਾਰੇ ਵੀ ਸੋਚ ਸਕੇ ਬਾਕੀ ਆਪਣਾ ਆਪਣਾ ਆਪਣਾ ਪਰਸੈਪਸ਼ਨ ਹੁੰਦਾ ਹੈ ਪਰੰਤੂ ਇਹ ਚੀਜ਼ਾਂ ਹਨ ਜੋ ਕਿ ਮੈਨੂੰ ਸੁਧਾਰਨਾ ਚਾਹੀਦੀਆਂ ਹਨ